ਮੈਂ ਪਹਿਲੀ ਵਾਰ ਟੈਕਸ ਦੇ ਵਿੱਚ ਆਇਆ ਹਾਂ ਹੁਣ ਮੈਂ ਆਪਣੀ ਇਨਕਮ ਟੈਕਸ ਰਿਟਰਨ ਭਰਨੀ ਚਾਹੁੰਦਾ ਹਾਂ ਪਰ ਮੈਂ ਇਨਕਮ ਟੈਕਸ ਭਰਨ ਦੀ ਪ੍ਰਕਿਰਿਆ ਤੋਂ ਪੂਰੀ ਤਰ੍ਹਾ ਅਣਜਾਣ ਹਾਂ ਕੀ ਤੁਸੀਂ ਮੇਰੀ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਪ੍ਰਕਿਰਿਆ ਬਾਰੇ ਮੈਨੂੰ ਜਾਣਕਾਰੀ ਦੇ ਸਕਦੇ ਹੋ ਇਸ ਮਕਸਦ ਲਈ ਮੈਂ ਕਿਸੇ ਵਰਕਸ਼ਾਪ ਜਾਂ ਸੈਮੀਨਾਰ ਵਿੱਚ ਹਿੱਸਾ ਲੈਣ ਲਈ ਵੀ ਤਿਆਰ ਹਾਂ ਕਿਰਪਾ ਕਰਕੇ ਮੈਨੂੰ ਇਨਕਮ ਟੈਕਸ ਰਿਟਰਨ ਭਰਨ ਦੇ ਲਈ ਜੋ ਵੀ ਹਦਾਇਤਾਂ ਹਨ ਉਸ ਬਾਰੇ ਪੂਰੀ ਤਰ੍ਹਾ ਜਾਣਕਾਰੀ ਦਿੱਤੀ ਜਾਵੇ